ਬਾਲੀਵੁੱਡ ਅਤੇ ਟਾਲੀਵੁੱਡ ਨੇ ਭਾਰਤ ਦੇ ਫੈਸ਼ਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪੁਰਾਣੇ ਸਮੇਂ ਵਿੱਚ ਅਮੀ ਅਮਿਤਾਬ ਬੱਚਨ ਦੇ ਸਮੇਂ ਖੁੱਲੀਆਂ ਪੈਟਾਂ ਦਾ ਰਿਵਾਜ ਸੀ ਅਤੇ ਪੱਟਾਂ ਕੋਲੋ ਤੰਗ ਹੁੰਦੀਆਂ ਸੀ ਅਤੇ ਉਸਤੋਂ ਬਾਅਦ ਤੰਗ ਜੀਨਾਂ ਦਾ ਅਤੇ ਤੰਗ ਪੈਟਾਂ ਦਾ ਜਿੰਨਾ ਨੂੰ ਨੈਰੋਂ ਪੈਂਟ ਕਿਹਾ ਜਾਂਦਾ ਸੀ ਉਹਨਾਂ ਦਾ ਰਿਵਾਜ ਆਇਆ ਉਸਤੋਂ ਬਾਅਦ ਅੱਜ ਦੇ ਸਮੇਂ ਬਾਲੀਵੁੱਡ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਉਹਨਾਂ ਦੀਆਂ ਫਿਲਮਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਹੁਣ ਬੈਲ ਬੋਟਮ ਹੋ ਗਈਆਂ ਸਟੇਟ ਫਿੱਟ ਜੀਨਾਂ ਪੈਂਟਾਂ ਦਾ ਰਿਵਾਜ ਆਇਆ